ਹੈਲੋ ਸਤਿ ਸ਼੍ਰੀ ਅਕਾਲ ਜੀ ਸਾਡੇ ਪਠਾਨਕੋਟ ਵਿੱਚ ਜ਼ਿਆਦਾਤਰ ਹਿੰਦੂ ਰਹਿੰਦੇ ਆ ਬਾਕੀ ਉੱਦਾਂ ਹਰ ਭਾਈਚਾਰੇ ਦੇ ਬੰਦੇ ਆ ਸਿੱਖ ਧਰਮ ਦੇ ਵੀ ਆ ਕ੍ਰਿਸਚਨ ਧਰਮ ਦੇ ਵੀ ਆ ਮੁਸਲਿਮ ਵੀ ਆ ਹਰ ਧਰਮ ਦੇ ਬੰਦੇ ਰਹਿੰਦੇ ਆ ਰਲ ਮਿਲ ਕੇ ਰਹਿੰਦੇ ਆ ਕੋਈ ਜਾਤੀਵਾਦ ਦਾ ਉੱਦਾਂ ਰੌਲਾ ਰੱਪਾ ਨਹੀਂ ਹੈ ਬਾਕੀ ਰਲ ਮਿਲ ਕੇ ਰਹਿੰਦੇ ਆ ਮੰਦਰ ਵੀ ਹੈਗਾ ਆ ਗੁਰਦੁਆਰਾ ਵੀ ਹੈ ਚਰਚ ਵੀ ਹੈ ਹਰ ਚੀਜ਼ ਹੈ ਸਾਡੇ ਗੁਰਦ ਪਠਾਨਕੋਟ ਦੇ ਵਿੱਚ ਅਤੇ ਪਠਾਨਕੋਟ 'ਚ ਜਦੋਂ ਵੀ ਸ਼ਿਵਰਾਤਰੀ ਹੁੰਦੀ ਹੈ ਜਾਂ ਕੋਈ ਜਨਮਅਸ਼ਟਮੀ ਹੁੰਦੀ ਆ ਹਿੰਦੂਆਂ ਦਾ ਕੋਈ ਵੀ ਤਿਉਹਾਰ ਹੁੰਦਾ ਹੈ ਅਤੇ ਧੂਮ ਧਾਮ ਮਨਾਇਆ ਜਾਂਦਾ ਜੇ ਮੁਸਲਮਾਨਾਂ ਦਾ ਹੁੰਦਾ ਜਿਸ ਤਰ੍ਹਾਂ ਕੇ ਹਰ ਸ਼ੁੱਕਰਵਾਰ ਨੂੰ ਰੋਜੇ ਰੋਡ 'ਤੇ ਇਹਦਾ ਮੁਸਲਮਾਨ ਆਪਣਾ ਕਰਦੇ ਹੈ ਪੂਜਾ ਆਪਣੀ ਰੀਤੀ ਰਿਵਾਜ਼ਾ ਦੇ ਹਿਸਾਬ ਨਾਲ ਅਤੇ ਜਦੋਂ ਕ੍ਰਿਸ਼ਚਨਾਂ ਦਾ ਹੁੰਦਾ ਕ੍ਰਿਸਮਿਸ ਵਗੈਰਾ ਜਾਂ ਕੋਈ ਵੀ ਤਿਉਹਾਰ ਕ੍ਰਿਸ਼ਚਨਾਂ ਦਾ ਆਉਂਦਾ ਹੈ ਉਹ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਸਾਰੇ ਰਲ ਮਿਲ ਕੇ ਮਨਾਉਂਦੇ ਨੇ ਅਤੇ ਜਿਹੜਾ ਸਿੱਖਾਂ ਦਾ ਆ ਸਿੱਖਾਂ ਦੇ ਵੀ ਗੁਰਦੁਆਰੇ ਕਾਫੀ ਪਠਾਣਕੋਟ 'ਚ ਸਿੱਖਾਂ ਦਾ ਵੀ ਹਰ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾਂਦਾ ਜਾਂ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਦੁਖੀ ਦੁਖੀ ਦਿਹਾੜਾ ਜਦੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀਗਾ ਦੀਵਾਰ ਵਿੱਚ ਉਹਦਾ ਵੀ ਦੁੱਖ ਪ੍ਰਗਟ ਕੀਤਾ ਜਾਂਦਾ ਰਲ ਮਿਲ ਕੇ ਸਾਰੇ ਪਠਾਨਕੋਟ 'ਚ ਕਾਫੀ ਏਕਤਾ ਆ ਕੋਈ ਧਰਮ ਜਾਤੀਵਾਦ ਦਾ ਉੱਦਾਂ ਦਾ ਕੋਈ ਰੌਲਾ ਨਹੀਂ ਜਿੱਦਾਂ ਮਤਲਬ ਕਿ ਹੋਰ ਸ਼ਹਿਰਾਂ 'ਚ ਹੁੰਦਾ ਹੋਊਗਾ ਬਹੁਤ ਨਰਮ ਭਾਵ ਨਰਮ ਦਿਲ ਦੇ ਲੋਕ ਨੇ ਇੱਥੇ ਰਲ ਮਿਲ ਕੇ ਰਹਿੰਦੇ ਨੇ ਅਤੇ ਕਾਫੀ ਅੱਛਾ ਸੁਭਾਵ ਆ ਅਤੇ ਕਾਫੀ ਅੱਛਾ ਸ਼ਹਿਰ ਹੈ ਹਰ ਚੀਜ਼ ਅਵੇਲੇਬਲ ਹੈ ਇੱਥੇ ਵਧੀਆ ਸਿਟੀਜਨ ਸਾਰੇ ਵਧੀਆ ਨੇ ਇੱਥੇ ਲੋਕ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਨੇ